ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬ ਵਿੱਚ ਬਹੁਤ ਜ਼ਰੂਰੀ ਹੈ ਪੰਜਾਬੀ ਭਾਸ਼ਾ ਕਿਉਂਕਿ ਸਾਡੀ ਮਾਤ ਭਾਸ਼ਾ ਹੈ ਇੱਕ ਜੰਮਦਾ ਬੱਚਾ ਜਦੋਂ ਪਹਿਲਾ ਵਰਡ ਬੋਲਦਾ ਹੈ ਅਤੇ ਉਹ ਪੰਜਾਬੀ ਹੀ ਬੋਲਦਾ ਹੈ ਬਹੁਤ ਜ਼ਰੂਰੀ ਹੈ ਕਿ ਹਰੇਕ ਨੂੰ ਪੰਜਾਬੀ ਆਉਣੀ ਚਾਹੀਦੀ ਹੈ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਪਿੰਡ ਦੇ ਨੇੜੇ ਵਾਲੇ ਸਕੂਲ ਜੋ ਸਰਕਾਰੀ ਸਕੂਲ ਜਿਹਨਾਂ ਨੂੰ ਕਿਹਾ ਜਾਂਦਾ ਹੈ ਉੱਥੇ ਹੀ ਪੜ੍ਹਾਉਂਦੇ ਹਨ ਕਿਉਂਕਿ ਉੱਥੇ ਜ਼ਿਆਦਾ ਪੰਜਾਬੀ ਵਰਤੀ ਜਾਂਦੀ ਹੈ ਇਸ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਆ ਤਾਂ ਜੋ ਬੱਚਾ ਜ਼ਿਆਦਾ ਪੰਜਾਬੀ ਸਿੱਖ ਸਕੇ ਇੰਗਲਿਸ਼ ਨਾਲੋਂ ਇਹੀ ਯਤਨ ਹੈ ਕਿ ਜ਼ਿਆਦਾ ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਪਾਉਣ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਸਿੱਖ ਸਕਣ ਘਰ ਵਿੱਚ ਵੀ ਆਮ ਤੌਰ ਲੋਕ ਪੰਜਾਬੀ ਹੀ ਬੋਲਦੇ ਹਨ ਜੇ ਵੱਡੇ ਪੰਜਾਬੀ ਬੋਲਣਗੇ ਤਾਂ ਛੋਟੇ ਉਹਨਾਂ ਵੱਲ ਦੇਖ ਕੇ ਖੁਦ ਬ ਖੁਦ ਪੰਜਾਬੀ ਬੋਲਦੇ ਹਨ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਹੀ ਯਤਨ ਹੈ ਕਿ ਲੋਕ ਸਾਰੇ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਪਾਉਣ ਅਤੇ ਪੰਜਾਬੀ ਹੀ ਜ਼ਿਆਦਾ ਪੜ੍ਹਨ ਲਿਖਣ ਤਾਂ ਜੋ ਆਪਣੀ ਮਾਤ ਭਾਸ਼ਾ ਤੋਂ ਜਾਣੂ ਹੋ ਸਕਣ ਧੰਨਵਾਦ